ਪੰਜਾਬੀ ਭਾਸ਼ਾ ਪੰਜਾਬ ਦੇ ਖਿੱਤੇ ਦੇ ਨਾਲ ਜੁੜੀ ਹੋਈ ਹੈ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ

ਇਹਦਾ ਇਤਿਹਾਸ ਪੰਜਾਬ ਦੇ ਖਿੱਤੇ ਦੇ ਨਾਲ ਜੁੜਿਆ ਹੋਇਆ ਪੰਜਾਬੀ ਭਾਸ਼ਾ ਦਾ ਲੰਮੇਰਾ ਇਤਿਹਾਸ ਹੈ ਪਰ ਇਹਨੂੰ ਲਿਖਣ ਦੇ ਲਈ ਜਿਹੜੀ ਲਿਪੀ ਆ ਜਿਹਨੂੰ ਗੁਰਮੁਖੀ ਕਿਹਾ ਜਾਂਦਾ ਉਹ ਗੁਰਮੁਖੀ ਦਾ ਪ੍ਰਚਲਨ ਜਿਹੜਾ ਉਹ ਸਿੱਖ ਗੁਰੂ ਸਾਹਿਬਾਨ ਤੋਂ ਬਾਅਦ ਵਿੱਚ ਹੁੰਦਾ ਕਿਉਂਕਿ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਦੇ ਵਿੱਚ ਗੁਰਮੁਖੀ ਲਿਪੀ ਦਾ ਜਿਹੜਾ ਉਹ ਆਰੰਭ ਕੀਤਾ ਉਹਦੀ ਸਿਰਜਣਾ ਕੀਤੀ ਗੁਰਮੁਖੀ ਲਿਪੀ ਦੇ ਵਿੱਚ ਹੀ ਪੰਜਾਬੀ ਭਾਸ਼ਾ ਨੂੰ ਲਿਖਣ ਦਾ ਜਿਹੜਾ ਉਦਮ ਉਪਰਾਲਾ ਕੀਤਾ ਗਿਆ ਪਹਿਲਾਂ ਪੰਜਾਬੀ ਭਾਸ਼ਾ ਜਿਹੜੀ ਠੇਠ ਪੰਜਾਬੀ ਭਾਸ਼ਾ ਆਮ ਪੰਜਾਬ ਦੇ ਖਿੱਤੇ ਦੇ ਵਿੱਚ ਬੋਲੀ ਜਾਂਦੀ ਸੀਗੀ ਉਹਨੂੰ ਲਿਖਣ ਦੇ ਲਈ ਹੋਰ ਲਿਪੀਆਂ ਜਿਹੜੀਆਂ ਉਹ ਅਪਣਾਈਆਂ ਜਾਂਦੀਆਂ ਸਨ ਪਰ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਨੇ ਉਹ ਧੁਨੀਆਂ ਹੋਰ ਕਿਸੇ ਵੀ ਲਿਪੀ ਦੇ ਵਿੱਚ ਸਮੋ ਨਹੀਂ ਸਕਦੀਆਂ ਕੇਵਲ ਅਤੇ ਕੇਵਲ ਗੁਰਮੁਖੀ ਲਿਪੀ ਹੀ ਐਸੀ ਹੈ ਜਿਹੜੀ ਪੰਜਾਬੀ ਭਾਸ਼ਾ ਦੀਆਂ ਲਿਪੀਆਂ ਨੂੰ ਧੁਨੀਆਂ ਨੂੰ ਆਪਣੇ ਅੰਦਰ ਸਮੋ ਸਕਦੀ ਹੈ ਉਹਨਾਂ ਨੂੰ ਵਿਅਕਤ ਕਰ ਸਕਦੀ ਹੈ ਇਸ ਕਰਕੇ ਪੰਜਾਬੀ ਭਾਸ਼ਾ ਦਾ ਇਤਿਹਾਸ ਤਾਂ ਲੰਮਾ ਬਹੁਤ ਲੰਮਾ ਪਰ ਇਹਨੂੰ ਲਿਖਣ ਦਾ ਜਿਹੜਾ ਸਹੀ ਰੂਪ ਦੇ ਵਿੱਚ ਉਹ ਜਿਹੜਾ ਗੁਰਮੁਖੀ ਦੇ ਆਰੰਭ ਤੋਂ ਹੁੰਦਾ ਗੁਰਮੁਖੀ ਲਿਪੀ ਦਾ ਜਿਹੜਾ ਆਰੰਭ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਮੰਨਿਆ ਜਾਂਦਾ ਅਤੇ ਉਹਨਾਂ ਤੋਂ ਬਾਅਦ ਫਿਰ ਵੱਖ ਵੱਖ ਗੁਰੂ ਸਾਹਿਬਾਨ ਦੌਰਾਨ ਗੁਰਮੁਖੀ ਦਾ ਵਿਕਾਸ ਹੋਇਆ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ ਪੰਜਾਬੀ ਭਾਸ਼ਾ ਸਮੇਂ ਸਮੇਂ 'ਤੇ ਵਿਕਸਿਤ ਇਸ ਤਰੀਕੇ ਦੇ ਨਾਲ ਹੋਈ ਆ ਕਿਉਂਕਿ ਇਹਨੂੰ ਬਹੁਤ ਸਾਰੇ ਲੋਕਾਂ ਨੇ ਅਪਣਾਇਆ ਖਾਸ ਕਰਕੇ ਪੰਜਾਬ ਦੇ ਖਿੱਤੇ ਦੇ ਵਿੱਚ ਪੰਜਾਬੀਆਂ ਨੇ ਜਦੋਂ ਪ੍ਰਵਾਸ ਕੀਤਾ ਪੰਜਾਬੀ ਜਦੋਂ ਆਪਣੀ ਇਸ ਸਰਜਮੀਂ ਨੂੰ ਛੱਡ ਕੇ ਵੱਖ ਵੱਖ ਦੇਸ਼ਾਂ ਦੇ ਵਿੱਚ ਗਏ ਨੇ ਕਨੇ ਕਨੇਡਾ ਅਮੈਰੀਕਾ ਇੰਗਲੈਂਡ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਗਏ ਨੇ ਉੱਥੇ ਜਾ ਕੇ ਜਦੋਂ ਪੰਜਾਬੀ ਵਿਚਰੇ ਨੇ ਉਹਨਾਂ ਨੇ ਉੱਥੇ ਜਾ ਕੇ ਵੀ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕੀਤਾ ਜਿਹਦੇ ਕਰਕੇ ਪੰਜਾਬੀ ਭਾਸ਼ਾ ਵਿਕਸਿਤ ਹੋਈ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਸ਼ਬਦ ਇੰਨੇ ਆਪਣੇ ਝੋਲੀ ਦੇ ਵਿੱਚ ਪੁਆਏ ਵੀ ਅਤੇ ਬਹੁਤ ਸਾਰੇ ਸ਼ਬਦ ਇਹਦੇ ਵੀ ਹੋਰਨਾਂ ਭਾਸ਼ਾ ਦੇ ਭਾਸ਼ਾਵਾਂ ਦੇ ਵਿੱਚ ਵੀ ਗਏ ਇਸ ਤਰੀਕੇ ਦੇ ਨਾਲ ਇਸ ਪੰਜਾਬੀ ਭਾਸ਼ਾ ਨੇ ਸਮੇਂ ਸਮੇਂ 'ਤੇ ਆਪਣਾ ਵਿਕਾਸ ਕੀਤਾ